ਗਾਇਕੀ ਵਿੱਚ ਭਾਵਨਾਵਾਂ ਦਾ ਮਹੱਤਵ ਉਸ ਤਰ੍ਹਾਂ ਹੈ ਜਿਸ ਤਰ੍ਹਾਂ ਤੁਹਾਡੇ ਲਈ ਖਾਣ ਤੋਂ ਬਾਅਦ ਅੰਦਰ ਸ਼ਕਤੀ ਮਹਿਸੂਸ ਕਰਨਾ ਗਾਇਕੀ ਵਿੱਚ ਜੇਕਰ ਭਾਵਨਾ ਨਹੀਂ ਹੈ ਤਾਂ ਉਹ ਤੁਹਾਨੂੰ ਜਾਂ ਤੁਹਾਡੇ ਸਰੋਤੇ ਨੂੰ ਨਹੀਂ ਟੁੰਬਦੀ ਇਸ ਕਰਕੇ ਤੁਹਾਡੀ ਗਾਇਕੀ ਵਿੱਚ ਭਾਵਨਾ ਪ੍ਰਗਟ ਹੋਣੀ ਚਾਹੀਦੀ ਹੈ ਜੇਕਰ ਉਹ ਭਾਵਨਾ ਨਹੀਂ ਹੋਵੇਗੀ ਤਾਂ ਉਹ ਸੰਗੀਤ ਸਿਰਫ ਸ਼ੋਰ ਹੋਵੇਗਾ ਇਸ ਕਰਕੇ ਗਾਇਕੀ ਵਿੱਚ ਭਾਵਨਾਵਾਂ ਉਸ ਤਰ੍ਹਾਂ ਹਨ ਜਿਵੇਂ ਇੱਕ ਸਰੀਰ ਵਿੱਚ ਰੂਹ ਮੈਂ ਜਦੋਂ ਕਿਸੀ ਗਾਇਕੀ ਵੱਲ ਜਾਂ ਜਦੋਂ ਕੋਈ ਅਲਾਪ ਲਾਉਂਦਾ ਹਾਂ ਜਦੋਂ ਮੈਂ ਗਾਉਂਦਾ ਹਾਂ ਜੇਕਰ ਮੇਰਾ ਗਾਇਆ ਹੋਇਆ ਸਾਹਮਣੇ ਵਾਲੇ ਨੂੰ ਪ੍ਰਭਾਵਿਤ ਨਹੀਂ ਕਰਦਾ ਤਾਂ ਮੈਨੂੰ ਉਸ ਦਾ ਕੋਈ ਫਾਇਦਾ ਨਹੀਂ ਅਤੇ ਨਾ ਸਰੋਤੇ ਨੂੰ ਕੋਈ ਫਾਇਦਾ ਹੈ ਸੋ ਮੈਂ ਜਦੋਂ ਅਲਾਪ ਲਾਉਂਦਾ ਹਾਂ ਤਾਂ ਆਪਣੇ ਉਸ ਰਾਗ ਦੇ ਅਨੁਸਾਰ ਉਹਨਾਂ ਸਬਦਾਂ ਦੇ ਅਨੁਸਾਰ ਆਪਣੀ ਗਾਇਕੀ ਨੂੰ ਪ੍ਰਗਟ ਕਰਦਾ ਹਾਂ ਜਿਸ ਤਰ੍ਹਾਂ ਉਹਨਾਂ ਸ਼ਬਦਾਂ ਰਾਹੀਂ ਮੈਂ ਸਾਹਮਣੇ ਵਾਲੇ ਨੂੰ ਆਪਣੀ ਗੱਲ ਸਮਝਾ ਸਕਾਂ ਅਤੇ ਆਪਣੇ ਮਨ ਦੀ ਗੱਲ ਕਰ ਸਕਾਂ ਸੋ ਗਾਇਕੀ ਵਿੱਚ ਮੇਰੀਆਂ ਭਾਵਨਾਵਾਂ ਉਸ ਤਰ੍ਹਾਂ ਹਨ ਜਿਵੇਂ ਸੰਗੀਤ ਨੂੰ ਕਿਸੇ ਸਾਜ਼ ਦੀ ਜ਼ਰੂਰਤ ਹੈ